ਮੈਂ ਪਿਛਲੇ ਸਮੇਂ ਆਪਣਾ ਹਿਮਾਚਲ ਪ੍ਰਦੇਸ਼ ਮਨੀਕਰਨ ਸਾਹਿਬ ਅਤੇ ਲੇਹ ਲੱਦਾਖ ਦੇ ਵਿੱਚ ਪੈਂਦੇ ਪੱਥਰ ਸਾਹਿਬ ਗੁਰਦੁਆਰਾ ਘੁੰਮਣ ਗਿਆ ਤਾਂ ਜਿਹੜੇ ਹਿਮਾਚਲੀ ਹੈ ਉਹ ਬਹੁਤ ਹੀ ਉਹਨਾਂ ਨਾਲ ਬ ਪੰਜਾਬੀਆਂ ਜਾਂ ਆਲਮੋਸਟ ਪੂਰੇ ਇੰਡੀਆ ਦੇ ਲੋਕਾਂ ਦੇ ਨਾਲ ਬੜੇ ਰੂੜ ਬਿਹੇਵਰ ਨਾਲ ਗੱਲ ਕਰਦੇ ਹੈ ਅਤੇ ਉਹਨਾਂ ਦੇ ਕਹਿਣੀ ਅਤੇ ਕਰਨੀ ਦੇ ਵਿੱਚ ਬਹੁਤ ਫਰਕ ਹੈ ਅਤੇ ਜੋ ਕਹਿੰਦੇ ਉਹ ਕਰਦੇ ਨਹੀਂ ਹੈ ਦਰਸਅਲ ਅਤੇ ਕਦੇ ਵੀ ਤੁਸੀਂ ਦੁਕਾਨ 'ਤੇ ਜਾਉ ਤਾਂ ਪ੍ਰਿੰਟ ਰੇਟ ਤੋਂ ਵੱਧ ਦਾ ਜਿਹੜਾ ਲ ਸਮਾਨ ਕੋਈ ਵੀ ਲਉਂਗੇ ਤਾਂ ਪ੍ਰਿੰਟ ਰੇਟ ਤੋਂ ਵੱਧ ਸਮਾਨ ਹੈ ਵੇਚਦੇ ਹੈ ਰੇਟ ਜ਼ਿਆਦਾ ਲੈਂਦੇ ਹੈ ਅਤੇ ਮੈਂ ਉੱਥੇ ਦੇਖਿਆ ਵੀ ਇੱਥੇ ਬਹੁਤ ਜ਼ਿਆਦਾ ਯਾਤਰੀਆਂ ਦੇ ਨਾਲ ਵਿਤਕਰਾ ਹੁੰਦਾ ਅਤੇ ਬਹੁਤ ਜ਼ਿਆਦਾ ਪੰਜਾਬੀ ਲੋਕਾਂ ਜਾਂ ਇੰਡੀਆ ਦੇ ਆਲ ਸਾਊਥ ਇੰਡੀਅਨ ਜਾਂ ਕਿਧਰੋਂ ਵੀ ਨੌਰਥ ਤੋਂ ਆਉਂਦੇ ਆ ਲੋਕ ਉਹਨਾਂ ਨਾਲ ਵਿਤਕਰਾ ਕਰਦੇ ਹੈ